ਮੈਨੂੰ ਹਾਈਕਿੰਗ ਕਰਨ ਵਾਸਤੇ ਪਹਾੜਾਂ ਅਤੇ ਬੀਚ 'ਤੇ ਜਾਣਾ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਜਦੋਂ ਵੀ ਪਹਾੜ ਤਾਂ ਪਹਾੜਾਂ 'ਤੇ ਵੀ ਅਤੇ ਹਾਈਕ ਕਰਨ ਜਾਂਦੇ ਹਾਂ ਤਾਂ ਉੱਥੇ ਜਾ ਕੇ ਆਪਣੀ ਸੁਬਹਾ ਸੁਬਹਾ ਸਵੇਰੇ ਸਵੇਰੇ ਹਾਈਕ ਕਰਨ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਹੈ ਅਤੇ ਉੱਥੋਂ ਦੇ ਪਹਾੜਾਂ ਦਾ ਜੋ ਦ੍ਰਿਸ਼ ਹੈ ਨੀਚੇ ਦਾ ਦ੍ਰਿਸ਼ ਹੈ ਉਹ ਬਹੁਤ ਹੀ ਸੋਹਣਾ ਅਤੇ ਦੇਖਣ ਯੋਗ ਹੁੰਦਾ ਹੈ ਪੰਛੀਆਂ ਦੀ ਚੰਨਚਨਾਹਟ ਅਤੇ ਬਹੁਤ ਹੀ ਸੁਰੀਲੀ ਪੰਛੀਆਂ ਦੀਆਂ ਆਵਾਜ਼ਾਂ ਹੈ ਜੋ ਸੁਣ ਕੇ ਬਹੁਤ ਹੀ ਮਨ ਸ਼ਾਂਤ ਹੁੰਦਾ ਹੈ ਪਹਾੜਾਂ 'ਤੇ ਐਕ ਜਾਣ ਹਾਈਕ ਕਰਨ ਕਾਰਣ ਆਪਣੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਜੋ ਸਰੀਰ ਨੂੰ ਬਹੁਤ ਹੀ ਤਰੋਤਾਜਗਾਹ ਅਤੇ ਸੁਰਕਸ਼ਿਤ ਰੱਖਦੀ ਹੈ ਸ ਅਤੇ ਪਹਾੜਾਂ ਦੇ ਉੱਤੇ ਜਾਣ ਕਾਰਣ ਬਹੁਤ ਹੀ ਵਧੀਆ ਅਤੇ ਬੱਦਲਵਾਈ ਵੀ ਸਾਫ਼ ਦਿਖਦੀ ਹੈ ਅਤੇ ਮੈਨੂੰ ਬੀਚ 'ਤੇ ਜਾਣ ਕਰਕੇ ਬਹੁਤ ਹੀ ਵਧੀਆ ਅਤੇ ਠੰਡਕ ਮਹਿਸੂਸ ਹੁੰਦੀ ਹੈ ਜਦੋਂ ਵੀ ਆਪਾਂ ਬੀਚ 'ਤੇ ਹਾਈਕ ਕਰਨ ਜਾਂਦੇ ਹਾਂ ਤਾਂ ਉੱਥੋਂ ਦਾ ਜੋ ਚਾਰੇ ਪਾਸੇ ਦਾ ਜੋ ਪਾਣੀ ਹੈ ਜੋ ਵਹਿੰਦਾ ਰਹਿੰਦਾ ਹੈ ਉਹ ਜਿਸ ਕਾਰਣ ਉਹ ਇਲਾਕਾ ਬਹੁਤ ਹੀ ਠੰਡਾ ਹੁੰਦਾ ਹੈ ਅਤੇ ਜੋ ਮੈਨੂੰ ਬਹੁਤ ਹੀ ਵਧੀਆ ਅਤੇ ਠੰਡਕ ਮਹਿਸੂਸ ਹੁੰਦਾ ਹੈ ਅਤੇ ਉੱਥੋਂ ਦਾ ਜੋ ਸੂਰਜ ਡੁੱਬਣ ਦਾ ਦ੍ਰਿਸ਼ ਹੈ ਉਹ ਬਹੁਤ ਹੀ ਅਨੋਖਾ ਅਤੇ ਬਹੁਤ ਹੀ ਦੇਖਣ ਯੋਗ ਹੁੰਦਾ ਜਦੋਂ ਸੂਰਜ ਉੱਥੋਂ ਡੁੱਬਦਾ ਹੈ ਤਾਂ ਉਹਦੇ ਚਾਰੇ ਪਾਸੇ ਲਾਲੀ ਆਈ ਹੁੰਦੀ ਹੈ ਜੋ ਦ੍ਰਿਸ਼ ਦੇਖਣ ਯੋਗ ਹੁੰਦਾ ਹੈ ਅਤੇ ਬਹੁਤ ਹੀ ਸੋਹਣਾ ਲੱਗਦਾ ਹੈ